ਭੰਗੜਾ ਐਰੋਬਿਕਸ ਇੱਕ ਕਾਰਡੀਓ ਕਸਰਤ ਮੰਨੀ ਜਾਂਦੀ ਹੈ ਭੰਗੜਾ ਕਰਨ ਨਾਲ ਮਨੁੱਖ ਵਿੱਚ ਇੱਕ ਅਲੱਗ ਹੀ ਫੁਰਤੀ ਪੈਦਾ ਹੁੰਦੀ ਹੈ ਨਾਲ ਉਸਦਾ ਸ਼ਰੀਰ ਵੀ ਸਿਹਤਮੰਦ ਹੁੰਦਾ ਹੈ ਭੰਗੜਾ ਪੰਜਾਬ ਪੰਜਾਬੀ ਸੰਗੀਤ ਸੰਗੀਤ 'ਤੇ ਹੁੰਦਾ ਹੈ ਪੰਜਾਬੀ ਗਾਣਿਆਂ 'ਤੇ ਹੁੰਦਾ ਹੈ ਜੋ ਕਿ ਤੇਜ਼ ਬੀਟ ਵਾਲੇ ਹੁੰਦੇ ਹਨ ਤੇਜ਼ ਬੀਟ ਵਾਲੇ ਗਾਣਿਆਂ 'ਤੇ ਹੀ ਭੰਗੜਾ ਹੁੰਦਾ ਹੈ ਅਤੇ ਇਹ ਇੱਕ ਤਾਂ ਭੰਗੜਾ ਕਰਨ ਨਾਲ ਆਪਣੇ ਸ਼ਰੀਰ ਵਿੱਚ ਇੱਕ ਜੋਸ਼ ਪੈਦਾ ਹੁੰਦਾ ਹੈ ਅਤੇ ਨਾ ਕੇਵਲ ਇਹ ਆਪਣੇ ਸ਼ਰੀਰਿਕ ਤੌਰ 'ਤੇ ਬਲਕਿ ਮਾਨਸਿਕ ਤੌਰ 'ਤੇ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ